ਬਰਤਨ ਧੋਣ ਦੀ ਪ੍ਰਕਿਰਿਆ ਬਹੁਤ ਆਸਾਨ ਹੈ ਮੋਸਟਲੀ ਜੋ ਔਰਤਾਂ ਨੇ ਘਰ 'ਚ ਬਰਤਨ ਆਪ ਹੀ ਧੋਂਦੀਆਂ ਹਨ ਪਹਿਲਾਂ ਪਹਿਲਾਂ ਹੁੰਦਾ ਸੀ ਜਦੋਂ ਬਰਤਨ ਧੋਣੇ ਬਹੁਤ ਔਖੇ ਮੰਨੇ ਜਾਂਦੇ ਸੀ ਅਤੇ ਲੋਕੀ ਸਵਾਹ ਲਿਆ ਕੇ ਬਰਤਨ ਧੋਂਦੇ ਸੀਗੇ ਅਤੇ ਉਹ ਬਰਤਨ ਜੋ ਭਾਂਡਾ ਸੀ ਉਹ ਸ਼ੁੱਧ ਵੀ ਮੰਨਿਆ ਹੁੰਦਾ ਸੀ ਲੇਕਿਨ ਸਮੇਂ ਦੇ ਨਾਲ ਜਿੱਦਾਂ ਜਿੱਦਾਂ ਸਾਡਾ ਜੋ ਜੀਵਨ ਸ਼ੈਲੀ ਹੈ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਹੈ ਅਤੇ ਲੋਕੀ ਆਸਾਨ ਤਰੀਕੇ ਲੱਭਦੇ ਨੇ ਅੱਜ ਕੱਲ੍ਹ ਪਾਣੀ ਪਾਣੀ ਅਤੇ ਸਰਫ ਦੇ ਨਾਲ ਸਟੀਲ ਦੇ ਭਾਂਡੇ ਆਸਾਨੀ ਨਾਲ ਧੋ ਦਿੱਤੇ ਜਾਂਦੇ ਨੇ ਅਤੇ ਇਹੀ ਵਧੀਆ ਤਰੀਕਾ ਲੇਕਿਨ ਤੇਲ ਵਾਲੇ ਬਰਤਨਾਂ ਨੂੰ ਸਾਫ ਕਰਨਾ ਕਾਫੀ ਔਖਾ ਮੰਨਿਆ ਜਾਂਦਾ ਖਾਸ ਕਰਕੇ ਸਰਦੀ ਦੇ ਮੌਸਮ 'ਚ ਕਿਉਂਕਿ ਤੇਲ ਘਿਓ ਜੋ ਹੈ ਉਹ ਭਾਂਡਿਆਂ ਵਿੱਚ ਹੀ ਜੰਮ ਜਾਂਦਾ ਜਾਂ ਫਿਰ ਆਪਾਂ ਕੋਈ ਸਬਜ਼ੀ ਬਣਾਉਂਦੇ ਹਾਂ ਅਤੇ ਭਾਂਡਿਆਂ ਦੇ ਵਿੱਚ ਤੇਲ ਜੋ ਜੰਮਿਆ ਰਹਿ ਜਾਂਦਾ ਅਗਰ ਉਹ ਤੇਲ ਜੰਮਿਆ ਰਹਿ ਜਾਵੇ ਤਾਂ ਅਗਲੇ ਖਾਣੇ ਦੇ ਵਿੱਚ ਅਤੇ ਬਰਤਨ ਦੇ ਵਿੱਚ ਉਹਦੀ ਮਹਿਕ ਗੰਦੀ ਜਿਹੀ ਸਮੈਲ ਜਿਹੜੀ ਹੈ ਉਹ ਆਉਂਦੀ ਰਹਿੰਦੀ ਹੈ ਇਹਨੂੰ ਸਾਫ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਵੈ ਕਿ ਤੁਸੀਂ ਪਾਣੀ ਗਰਮ ਕਰੋ ਜਿਹੜਾ ਤੁਸੀਂ ਸਰਫ ਯੂਜ ਕਰਦੇ ਹੋ ਮੈਂ ਯੂਜ ਕਰਦੀ ਹਾਂ ਵਿਮ ਜਾਂ ਫਿਰ ਪਰਿਲ ਉਹ ਲਿਕੁਅਡ ਹੁੰਦਾ ਉਹਦੇ ਵਿੱਚ ਗਰਮ ਪਾਣੀ ਦੇ ਵਿੱਚ ਪਾਓ ਥੋੜ੍ਹਾ ਦੇਰ ਲਈ ਉਹਨੂੰ ਰਹਿਣ ਦਿਓ ਅਤੇ ਫਿਰ ਬਰਤਨ ਸਾਫ ਕਰੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਤੋਂ ਵੀ ਜ਼ਿਆਦਾ ਮਹਿਕ ਆਵੇ ਭਾਂਡੇ ਵਿੱਚ ਤੁਸੀਂ ਗਰਮ ਪਾਣੀ ਬਰਤਨ 'ਚ ਰੱਖੋ ਜਿਹੜਾ ਭਾਂਡਾ ਤੁਸੀਂ ਤੇਲ ਵਾਲਾ ਸਾਫ ਕਰਨਾ ਉਹਦੇ ਵਿੱਚ ਨਿੰਬੂ ਨੂੰ ਨਚੋੜੋ ਅਤੇ ਕੁਝ ਟਾਈਮ ਦੇ ਲਈ ਪੰਜ ਤੋਂ ਦਸ ਮਿੰਟ ਲਈ ਉਹਨੂੰ ਇੱਦਾਂ ਹੀ ਰਹਿਣ ਦਿਓ ਜਿਹੜੀ ਉਹਦੀ ਗੰਦੀ ਸਮੈਲ ਹੈ ਤੇਲ ਦੀ ਉਹ ਸਾਰਾ ਨਿੰਬੂ ਜੋ ਹੈਗਾ ਉਹਨੂੰ ਚੂਸ ਲਏਗਾ ਅਤੇ ਜਿਹੜੀ ਸਮੈਲ ਹੈਗੀ ਉਹ ਚੱਲ ਜਾਏਗੀ ਉਸ ਤੋਂ ਬਾਅਦ ਤੁਸੀਂ ਇਹਨੂੰ ਨੋਰਮਲ ਜੋ ਤੁਸੀਂ ਸਰਫ ਦੇ ਨਾਲ ਉਹਨੂੰ ਮਾਂਜਦੇ ਹੋ ਤੁਸੀਂ ਮਾਂਜ ਲਓ ਭਾਂਡਾ ਇੱਕਦਮ ਸਾਫ ਸੁਥਰਾ ਹੋ ਜਾਏਗਾ